ਉਂਝ ਵੈਸੇ ਤਾਂ ਕਹਿੰਦੇ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸਹੂਲਤਾਂ ਬਰਾਬਰ ਦੀਆਂ ਹੋਈਆਂ ਪਰ ਅਜਿਹਾ ਨਹੀਂ ਹੈਗਾ ਕਿਉਂਕਿ ਸ਼ਹਿਰਾਂ ਦੇ ਵਿੱਚ ਜਿੰਨੀਆਂ ਜ਼ਿਆਦਾ ਸਹੂਲਤਾਂ ਹੈਗੀਆਂ ਪਿੰਡਾਂ ਦੇ ਵਿੱਚ ਉਸ ਤੋਂ ਘੱਟ ਹੀ ਹਨ ਜਿਸ ਤਰੀਕੇ ਨਾਲ ਵੀ ਸ਼ਹਿਰਾਂ ਦੇ ਵਿੱਚ ਹਸਪਤਾਲ ਨੇੜੇ ਹੈਗੇ ਕਿੰਨੇ ਮੌਲ ਖੁੱਲ੍ਹ ਗਏ ਸ਼ੋਪਿੰਗ ਕਰਨ ਵਾਸਤੇ ਕੋਈ ਵੀ ਚੀਜ਼ ਖਰੀਦਣ ਵਾਸਤੇ ਮਾਰਕੀਟਿੰਗ ਜ਼ਿਆਦਾ ਵੱਧ ਗਈ ਹੈਗੀ ਮਾਰਕੀਟ ਇੰਨੀ ਜ਼ਿਆਦਾ ਹੈਗੀ ਜਿਹੜੀ ਮਰਜ਼ੀ ਸ਼ੌਪਿੰਗ ਕਰ ਸਕਦੇ ਹਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਸ ਇਹ ਚੀਜ਼ ਹੈਗੀ ਕੁਛ ਕੁ ਜਿਵੇਂ ਹਸਪਤਾਲ ਖੁੱਲ੍ਹੇ ਹੋਏ ਹੈਗੇ ਵੀ ਤਾਂ ਵੀ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਦੇ ਵਿੱਚ ਜਾ ਕੇ ਆਪ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪੈਂਦਾ ਹੈਗਾ ਵੀ ਜਿੱਥੇ ਵੀ ਉਹ ਸ਼ਹਿਰਾਂ ਦੇ ਵਿੱਚ ਵੀ ਸਾਰੀ ਸਹੂਲਤ ਮਿਲਦੀ ਹੈਗੀ ਪਿੰਡਾਂ ਦੇ ਵਿੱਚ ਪਰ ਇੰਨੀਆਂ ਸਹੂਲਤ ਨਹੀਂ ਮਿਲਦੀਆਂ ਹੈਗੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਨਾਲੋਂ ਘੱਟ ਹੀ ਸਹੂਲਤਾਂ ਮਿਲਦੀਆਂ ਹਨ ਵੀ ਪਿੰਡਾਂ ਦਾ ਵਿਕਾਸ ਵੀ ਸ਼ਹਿਰਾਂ ਨਾਲੋਂ ਹਾਲੇ ਘੱਟ ਹੀ ਹੈ ਵੀ ਸ਼ਹਿਰਾਂ ਦੇ ਵਿਕਾਸ ਵੀ ਬਹੁਤ ਹੀ ਜ਼ਿਆਦਾ ਅੱਗੇ ਵੱਧ ਗਿਆ ਹੈ ਵੀ ਸ਼ਹਿਰਾਂ ਦੇ ਵਿੱਚ ਜਿਹੜੀ ਹਰੇਕ ਚੀਜ਼ ਉਪਲਬਧ ਹੈਗੀ ਕਿ ਜਿਹੜੀ ਚੀਜ਼ ਵੀ ਚਾਹੀਦੀ ਹੈਗੀ ਉਹੀ ਚੀਜ਼ ਹੁੰਦੀ ਹੈਗੀ ਅਤੇ ਜਿਹੜੀ ਸ਼ ਪਿੰਡਾਂ ਦੇ ਵਿੱਚ ਚੀਜ਼ ਹੈਗੀ ਪਿੰਡਾਂ ਦੇ ਵਿੱਚ ਚੀਜ਼ ਵੀ ਸ਼ਹਿਰ ਜਾ ਕੇ ਲਿਆਉਣੀ ਪੈਂਦੀ ਫਿਰ ਕਿਤੇ ਜਾ ਕੇ ਵਰਤੀ ਜਾਂਦੀ ਚੀਜ਼ ਉਹ ਪਰ ਸ਼ਹਿਰਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਸ਼ਹਿਰਾਂ ਦੇ ਵਿੱਚ ਤਾਂ ਜਦੋਂ ਹੀ ਜਾਓ ਬਜ਼ਾਰ ਜਾਓ ਮਾਰਕੀਟ ਇੰਨੀਆਂ ਖੁੱਲ੍ਹੀਆਂ ਘਰਾਂ ਦੇ ਕੋਲ ਇੰਨੇ ਹੈਗੇ ਸ਼ੋਪਿੰਗ ਵਾਸਤੇ ਕੋਈ ਵੀ ਕੱਪੜਾ ਲੀੜਾ ਖਰੀਦਣਾ ਹੈਗਾ ਪਰ ਜਿਹੜੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਵੀ ਕੋਈ ਕੱਪੜੇ ਲੀੜੇ ਖਰੀਦਣੇ ਆ ਜਾਂ ਫਿਰ ਚੱਪਲ ਵਗੈਰਾ ਕੋਈ ਹਸਪਤਾਲ 'ਚ ਦਵਾਈ ਬੂਟੀ ਚੰਗੀ ਲੈ ਕੇ ਆਉਣੀ ਚੰਗੀ ਦਵਾਈ ਬੂਟੀ ਵਾਸਤੇ ਵੀ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਪਿੰਡਾਂ ਵਾਲਿਆਂ ਨੂੰ ਥੈਂਕ ਯੂ